ਰਾਜ ਦੀਆਂ ਅਧਿਆਤਮਿਕ ਪਰੰਪਰਾਵਾਂ ਦਾ ਅਨੁਭਵ ਇਸ ਤਰ੍ਹਾਂ ਹੈ ਕਿ ਜਿਵੇਂ ਧਾਰਮਿਕ ਸਮਾਰੋਹ ਵਿੱਚੋਂ ਜੇ ਅਸੀਂ ਨਾਮ ਲਈਏ ਤਾਂ ਦੁਰਗਾ ਪੂਜਾ ਗਣੇਸ਼ ਪੂਜਾ ਜਿਵੇਂ ਕਿ ਦੁਰਗਾ ਪੂਜਾ ਵਾਲੇ ਦਿਨ ਨੌ ਦਿਨ ਮਾਤਾ ਦੀ ਮੂਰਤੀ ਨੂੰ ਰੱਖ ਕੇ ਉਸਦੀ ਪੂਜਾ ਕੀਤੀ ਜਾਂਦੀ ਹੈ ਅਤੇ ਨੌਵੇਂ ਦਿਨ ਫਿਰ ਕੰਜਕਾਂ ਬਿਠਾਈਆਂ ਜਾਂਦੀਆਂ ਹਨ ਫਿਰ ਬਾਅਦ ਵਿੱਚ ਜਿਵੇਂ ਧਾਰਮਿਕ ਸਮਾਰੋਹ ਵਿੱਚ ਹੋਰ ਵੀ ਬਹੁਤ ਸਾਰੇ ਗੁਰਦੁਆਰਿਆਂ 'ਚ ਪ੍ਰੋਗਰਾਮ ਕਰਵਾਏ ਜਾਂਦੇ ਹਨ ਜਿਵੇਂ ਦੇਖਿਆ ਜਾਵੇ ਤਾਂ ਗੁਰਦੁਆਰਿਆਂ ਵਿੱਚ ਇਹਨਾਂ ਧਾਰਮਿਕ ਸਮਾਰੋਹ ਦੇ ਨਾਲ ਨਾਲ ਵਿਸਾਖੀ ਵੀ ਮਨਾਈ ਜਾਂਦੀ ਹੈ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਈ ਗਈ ਆ ਸਿੱਖਾਂ ਦੇ ਦਸਵੇਂ ਗੁਰੂ ਸਨ ਜਿਨ੍ਹਾਂ ਨੇ ਵਿਸਾਖੀ ਵਾਲੇ ਦਿਨ ਹੀ ਇਹ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਅਤੇ ਮੰਦਰਾਂ ਗੁਰਦੁਆਰਿਆਂ ਦੇ ਨਾਲ ਨਾਲ ਸਾਰੀਆਂ ਪੂਜਾ ਜੋ ਕਿ ਪੰਜਾਬ ਵਿੱਚ ਜਾਂ ਫਿਰ ਰਾਜ ਵਿੱਚ ਹੀ ਮਨਾਈਆਂ ਜਾਂਦੀਆਂ ਹਨ